ਪੰਜਾਬ ਦੇ ਵਿੱਚ ਟੈਕਨੋਲੋਜੀ ਖੇਤਰ ਦੇ ਵਿੱਚ ਵਾਤਾਵਰਨ ਨੂੰ ਅਸੀਂ ਕਈ ਤਰੀਕਿਆਂ ਦੇ ਨਾਲ ਪ੍ਰਭਾਵਿਤ ਕਰ ਸਕਦੇ ਹਾਂ ਇਹਦਾ ਸਭ ਤੋਂ ਵੱਡਾ ਮੇਨ ਉਦਾਹਰਨ ਹੈ ਜਿਸ ਤਰ੍ਹਾਂ ਇਲੈਕਟਰੋਨਿਕ ਕਾਰਸ ਆ ਗਈਆਂ ਈ ਰਿਕਸ਼ਾ ਜਿਹਦੇ ਨਾਲ ਅਸੀਂ ਸਮਾਜ ਦੇ ਵਿੱਚ ਕਿਤੇ ਵੀ ਬੜੇ ਆਸਾਨੀ ਦੇ ਨਾਲ ਜਾ ਸਕਦੇ ਹਾਂ ਜਿਹਦੀ ਜਿਸ ਕਰਕੇ ਧੂੰਆਂ ਨਹੀਂ ਹੁੰਦਾ ਵਾਤਾਵਰਣ ਨੂੰ ਸੁਰਕਸ਼ਿਤ ਕਰਨ ਦਾ ਇਹ ਟੈਕਨੋਲੋਜੀ ਕਾਰਨ ਸਭ ਤੋਂ ਵਧੀਆ ਅੱਜ ਕੱਲ੍ਹ ਸਾਬਿਤ ਹੋ ਰਿਹਾ ਹੈ ਜਿਹਦੇ ਨਾਲ ਸਾਨੂੰ ਆਵਾਜ਼ ਵੀ ਘੱਟ ਆਉਂਦੀ ਹੈ ਹੋਰਨ ਦੀ ਵੀ ਬੱਚਤ ਹੁੰਦੀ ਹੈ ਧੂੰਏ ਦੀ ਵੀ ਬੱਚਤ ਹੁੰਦੀ ਹੈ ਇਸ ਕਰਕੇ ਇਹ ਐਹ ਟੈਕਨੋਲੋਜੀ ਵਾਤਾਵਰਨ ਦੇ ਉੱਤੇ ਬਹੁਤ ਪ੍ਰਭਾਵਿਤ ਹੈ ਔਰ ਇਹ ਸਮਾਰਟ ਹੋਮਸ ਦੇ ਵਿੱਚ ਜਿੱਦਾਂ ਇਲੈਕਟਰੋਨਿਕ ਚੁੱਲੇ ਆ ਗਏ ਹੈ ਇਹਦੀ ਵੀ ਵਰਤੋਂ ਘਰਾਂ ਦੇ ਵਿੱਚ ਬਹੁਤ ਔਰਤਾਂ ਖਾਨਾ ਬਣਾਉਣ ਦੇ ਵਿੱਚ ਵੀ ਕਰਦੀਆਂ ਹਨ ਇਸ ਤਰ੍ਹਾਂ ਦੇ ਟੈਕਨੋਲੋਜੀ ਪ੍ਰਭਾਵਿਤ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਟੈਕਨੋਲੋਜੀ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਲਈ ਇਹਦੇ ਹੋਰ ਵੀ ਕਈ ਆਵਿਸ਼ਕਾਰ ਕੀਤੇ ਜਾਂਦੇ ਹਨ ਜਿਹਦੇ ਕਾਰਨ ਸਾਡਾ ਵਾਤਾਵਰਨ ਸੇਫ ਰਵੇ ਅਤੇ ਇਹਦੇ ਨਾਲ ਸਾਡਾ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੋ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਹੋਰ ਵੀ ਵਾਤਾਵਰਣ ਨੂੰ ਸਵੱਛ ਰੱਖਣ ਲਈ ਇਹਨੂੰ ਹੋਰ ਵੀ ਬਹੁਤ ਵਧੀਆ ਇਹਦੇ ਕਾਰਨ ਦੱਸੇ ਜਾ ਸਕਦੇ ਹਨ ਇਹਦੇ 'ਤੇ ਖੋਜ ਕੀਤੀਆਂ ਜਾ ਸਕਦੀਆਂ ਹਨ ਸਾਡਾ ਪਰਿ ਵਾਤਾਵਰਨ ਸਵੱਛ ਔਰ ਸਾਫ ਰਹਿਣ ਲਈ ਇਹ ਸਭ ਤੋਂ ਵੱਡਾ ਆਵਿਸ਼ਕਾਰ ਹੈ ਇਲੈਕਟਰੋਨਿਕਸ ਸਾਡੀਆਂ ਕਾਰਾਂ ਈ ਰਿਕਸ਼ਾ ਔਰ ਕਈ ਪ੍ਰਕਾਰ ਦੇ ਘਰ ਦੇ ਵਿੱਚ ਯੂਜ ਹੋਣ ਵਾਲੀਆਂ ਚੀਜ਼ਾਂ ਹਨ